ਹਾਂਜੀ ਨਮਸਤੇ ਸਰ ਸਰ ਅਸੀਂ ਇੱਕ ਕੈਬ ਬੁੱਕ ਕਰਨਾ ਚਾਹੁੰਦੇ ਹਾਂ ਜੋ ਕਿ ਮੇਰੇ ਦੋਸਤ ਵਾਸਤੇ ਬੁੱਕ ਕਰਵਾਉਣੀ ਚਾਹੁੰਦੀ ਹਾਂ ਮੈਂ ਇਹ ਤੁਹਾਨੂੰ ਸ਼ਹਿਰੋਂ ਲੈ ਕੇ ਪਿੰਡ ਤੱਕ ਦੀ ਬੁੱਕ ਕਰਵਾਉਣਾ ਚਾਹੁੰਦੀ ਹਾਂ ਜਿਸ ਵਿੱਚ ਰਸਤੇ ਦਾ ਪੂਰਾ ਜ਼ਿਕਰ ਕੀਤਾ ਜਾਵੇਗਾ ਅਤੇ ਤੁਸੀਂ ਆਪਣੀ ਕੀਮਤ ਸਾਨੂੰ ਦੱਸ ਦੇਵੋ ਤਾਂ ਜੋ ਅਸੀਂ ਤੁਹਾਨੂੰ ਪੂਰੀ ਪੇਮੈਂਟ ਕਰ ਸਕੀਏ